ਸਾਡੇ ਇਤਿਹਾਸ ਵਿੱਚ ਸਾਡੇ ਇਲਾਕੇ ਜਾਂ ਸਾਡੀ ਜਿੰਦ ਜਾਨ ਸਾਡੇ ਪੰਜਾਬ ਬਾਰੇ ਮੈਂ ਗੱਲ ਕਰਨਾ ਚਾਹੂੰਗਾ ਪੰਜਾਬ ਪੰਜਾਬ ਨਾਮ ਤਿੰਨ ਅੱਖਰਾਂ ਦਾ ਹੈ ਜਿਹਦੇ ਵਿੱਚ ਦੋ ਜੋ ਨੇ ਲਗਾ ਮਾਤਰਾਵਾਂ ਲੱਗਦੀਆਂ ਨੇ ਟਿੱਪੀ ਤੇ ਕੰਨਾ ਪੱਪਾ ਪੱਪੇ ਨੂੰ ਟਿੱਪੀ ਜੱਜੇ ਨੂੰ ਕੰਨਾ ਬੱਪਾ ਪੰਜਾਬ ਇੱਕ ਬਹੁਤ ਦੇਖਣ ਨੂੰ ਛੋਟਾ ਸਾਦਾ ਪਰ ਪੰਜਾਬ ਆਪਣੇ ਆਪ ਵਿੱਚ ਇੰਨਾ ਜ਼ਿਆਦੇ ਵਿਸ਼ਾਲ ਹੈ ਕਿ ਗੱਲ ਕਰਦੇ ਕਰਦੇ ਮੈਨੂੰ ਦੋ ਮਿੰਟ ਨਹੀਂ ਮੈਨੂੰ ਤਾਂ ਤੁਸੀਂ ਕਹੋ ਤਾਂ ਚੌਬੀ ਘੰਟੇ ਵੀ ਮੈਨੂੰ ਬਹੁਤ ਜਿਆਦਾ ਘੱਟ ਪੈ ਜਾਣਗੇ ਪੰਜਾਬ ਨੂੰ ਠੀਕ ਹੈ ਤੇ ਪੰਜਾਬ ਵਿੱਚ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਰਾਜ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਕੀਤਾ ਉਹਨਾਂ ਦਾ ਰਾਜ ਪੂਰੇ ਇੰਟਰਨੈਸ਼ਨਲ ਲੈਵਲ ਤੇ ਬੀਬੀਸੀ ਦੇ ਮੁਤਾਬਿਕ ਹੁਣ ਤੱਕ ਦੇ ਪਿਛਲੇ ਪੰਜ ਸੌ ਸਾਲਾਂ ਦੇ ਵਿੱਚ ਸਭ ਤੋਂ ਇੱਕ ਨੰਬਰ ਤੇ ਰਾਜ ਮੰਨਿਆ ਗਿਆ ਸ਼ਾਸਕ ਮੰਨਿਆ ਗਿਆ ਤੇ ਸਾਡੇ ਇਨੇ ਮਹਾਨ ਯੋਧੇ ਹੋਏ ਨੇ ਜਿਨਾਂ ਦੇ ਨਾਮ ਮੈਂ ਕੁਝ ਕ ਦੇ ਨਾਂ ਲੈਨਾ ਬਾਬਾ ਦੀਪ ਸਿੰਘ ਜੀ ਸਰਦਾਰ ਹਰੀ ਸਿੰਘ ਨਲੂਆ ਜੀ ਤੇ ਪੰਜ ਹੱਥਾਂ ਜੀ ਤੇ ਬਹੁਤ ਸਾਰੇ ਹੋਰ ਵੀ ਹੋਏ ਨੇ ਮਹਾਨ ਪਤਾ ਨਹੀਂ ਹਰ ਇੱਕ ਇਨਸਾਨ ਹੀ ਸਾਡੇ ਪੰਜਾਬ ਚ ਮਹਾਨ ਹੈ ਪੰਜਾਬ ਦੀ ਜਿੰਨੀ ਮਰਜ਼ੀ ਤਾਰੀਫ ਕਰਾ ਲਓ ਮੈਂ ਥੱਕ ਹੀ ਨਹੀਂ ਸਕਦਾ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਮੈਂ ਤਾਂ ਵਿਦਾ ਲੈਣਾ ਚਾਹੂੰਗਾ ਸਾਸਰੀਕਾਲ ਜੀ